ਹਾਂਜੀ ਪਿੰਡਾਂ ਦੇ ਵਿਆਹਾਂ ਬਾਰੇ ਪਿੰਡਾਂ ਦੇ ਲੋਕ ਜਿਹੜੇ ਵਿਆਹਾਂ ਵਿਆਹ ਵਾ ਪੰਜਾਬੀ ਲੋਕ ਉਹ ਵਿਆਹਾਂ ਵਿਆਹ ਜਿਹੜੇ ਆ ਬਹੁਤ ਹੀ ਧੂਮ ਧਾਮ ਨਾਲ ਕਰਦੇ ਹਨ ਪੂਰੇ ਗੱਜ ਵੱਜ ਕੇ ਕਰਦੇ ਹਨ ਅਤੇ ਉਹ ਵਿਆਹ ਤੋਂ ਮਤਲਬ ਜਦੋਂ ਵਿਆਹ ਹੁੰਦਾ ਵਾ ਉਹ ਆਪਣੇ ਸ਼ਰੀਕੇ ਦੀ ਰੋਟੀ ਕਰਦੇ ਹਨ ਭਾਈਚਾਰੇ ਨੂੰ ਸੱਦਦੇ ਹਨ ਅਤੇ ਮਤਲਬ ਕਿ ਉਹ ਤਿੰਨ ਚਾਰ ਦਿਨ ਜਿੱਦਾਂ ਵੀ ਆਪਣੇ ਭਾਈਚਾਰੇ ਨੂੰ ਰੋਟੀ ਖਵਾਉਂਦੇ ਹਨ ਜੇ ਤਾਂ ਬਰਾਤ 'ਤੇ ਜਾਣਾ ਬਰਾਤ 'ਤੇ ਵੀ ਲੈ ਕੇ ਜਾਂਦੇ ਹਨ ਜਿੱਦਾਂ ਵੀ ਕੋਈ ਵੀ ਸ਼ਗਨ ਵਿਹਾਰ ਕਰਦੇ ਹਨ ਉਹ ਆਪਣੇੇ ਸ਼ਰੀਕੇ ਭਾਈਚਾਰੇ ਨੂੰ ਨਾਲ ਹੀ ਰੱਖਦੇ ਹਨ ਭੈਣ ਭਰਾਵਾਂ ਨੂੰ ਨਾਲ ਰੱਖਦੇ ਹਨ ਅਤੇ ਉਹ ਮਤਲਬ ਕਿ ਪੰਜਾਬੀ ਲੋਕ ਜਿਹੜੇ ਆ ਵਿਆਹ ਨੂੰ ਪੂਰਾ ਹੀ ਗੱਜ ਵੱਜ ਕੇ ਪੂਰੀਆਂ ਰੀਝਾਂ ਰਿਵਾਜ਼ਾਂ ਦੇ ਨਾਲ ਕਰਦੇ ਹਨ ਉਹ ਵਿਆਹ ਵਾਲੇ ਜਿੱਦਾਂ ਵੀ ਪਹਿਲਾਂ ਸੁਹਾਗ ਗਾਉਂਦੇ ਹਨ ਵਿਆਹ ਤੋਂ ਦੋ ਚਾਰ ਦਿਨ ਪਹਿਲਾਂ ਸੁਹਾਗ ਗਾਉਂਦੇ ਹਨ ਫਿਰ ਉਹਨਾਂ ਦੇ ਸ਼ਗਨ ਕੀਤੇ ਜਾਂਦੇ ਨੇ ਕੁੜੀ ਦੇ ਵਿਆਹ 'ਤੇ ਸੁਹਾਗ ਬੋਲਦੇ ਹਨ ਮੁੰਡੇ ਦੇ ਵਿਆਹ 'ਤੇ ਘੋੜੀਆਂ ਬੋਲੀਆਂ ਜਾਂਦੀਆਂ ਹਨ ਇਹਦਾ ਮਤਲਬ ਕਿ ਬਹੁਤ ਹੀ ਜ ਜਿਹੜੇ ਪੰਜਾਬੀ ਆ ਆਪਣੇ ਸ਼ਗਨ ਵਿਹਾਰ ਕਰਦੇ ਹਨ ਅਤੇ ਪੈਲਸ ਵਗੈਰਾ ਕਰਦੇ ਹਨ ਅਤੇ ਜਿਹੜੀ ਪਹਿਲੀ ਮੁਲਾਕਾਤ ਜਿੱਦਾਂ ਦਾ ਪ੍ਰਬੰਧ ਉਹ ਮਤਲਬ ਕਿ ਪਹਿਲਾਂ ਕੁੜੀ ਮੁੰਡੇ ਦੀ ਵੇਖ ਵਿਖਾਈ ਹੁੰਦੀ ਹੈ ਜੇ ਉਹਨਾਂ ਨੂੰ ਆਪਸ ਵਿੱਚ ਕੁੜੀ ਮੁੰਡਾ ਮਤਲਬ ਕਿ ਜਿੱਦਾਂ ਦੋ ਪਰਿਵਾਰਾਂ ਨੂੰ ਮੁੰਡਾ ਪਸੰਦ ਆ ਜਾਂ ਕੁੜੀ ਪਸੰਦ ਵਾ ਠੀਕ ਆ ਫਿਰ ਉਹ ਆਪਣਾ ਕੋਈ ਦਿਨ ਵਾਰ ਰੱਖ ਲੈਂਦੇ ਨੇ ਫਿਰ ਉਹਨਾਂ ਨੂੰ ਮਤਲਬ ਕਿ ਡੱਬਾ ਪੈਸਾ ਇੱਕ ਦੂਜੇ ਦੇ ਹੱਥ 'ਤੇ ਪੈਸੇ ਰੱਖ ਦਿੰਦੇ ਹਨ ਜਾਂ ਮੁੰਦਰੀ ਪਾ ਦਿੰਦੇ ਹਨ ਉਹਨੂੰ ਡੱਬੇ ਨਾਲ ਡੱਬਾ ਵਟਾ ਲੈਂਦੇ ਉਹਨ ਉਹ ਠਾਕਾ ਮੰਨਿਆ ਜਾਂਦਾ ਵਾ ਅਤੇ ਜਿੱਦਾਂ ਵੀ ਜਿਵੇਂ ਕਿ ਉਹ ਮਤਲਬ ਕਿ ਕਰਦੇ ਹਨ ਵੀ ਠਾਕਾ ਮੰਨਿਆ ਜਾਂਦਾ ਜਿੱਦਾਂ ਵੀ ਉਹ ਆਪਣਾ ਵਿਆਹ ਜਿਹੜਾ ਵਾ ਉਹ ਉਸ ਵਿਆਹ ਦਾ ਮਤਲਬ ਕਿ ਦਿਨ ਵਾਰ ਬੰਨ੍ਹ ਲੈਂਦੇ ਵੀ ਇਸ ਟਾਈਮ 'ਤੇ ਅਸੀਂ ਵਿਆਹ ਕਰਨਾ ਵਾ ਇਸ ਇਸ ਇਸ ਮਹੀਨੇ ਕਰਨਾ ਜਾਂ ਇਸ ਦਿਨ ਜਾਂ ਇਸ ਵਾਰ ਵਿਆਹ ਕਰਨਾ ਵਾ